ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਕੌਣ ਵਧੀਆ ਵਧੀਆ ਕੌਣ ਬੋਲਦਾ ਅੱਛਾ ਅੱਛਾ ਅੱਛਾ ਉਹ ਜਿਹੜੇ ਉਹ ਖੱਬੇ ਪਾਸੇ ਨਵੇਂ ਘਰ ਆਏ ਹੋ ਅੱਛਾ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਭੈਣੇ ਕੀ ਹਾਲ ਹੈ ਵਧੀਆ ਵਧੀਆ ਕੈਮ ਕੈਮ ਕੈਮ ਵਧੀਆ ਵਧੀਆ ਸਿਹਤਾ ਦਾ ਸੁਣਾਓ ਹੁਕਮ ਕਰ ਦੱਸੋ ਹੁਕਮ ਕਰੋ ਹਾਏ ਹਾਏ ਹਾਏ ਹਾਏ ਕਿੱਥੇ ਫਸ ਗਏ ਤੁਸੀਂ ਨਾ ਨਾ ਨਾ ਨਾ ਗਲੀ 'ਚੋਂ ਨਾ ਲਿਆ ਕਰੋ ਉਹ ਤਾਂ ਬੜਾ ਹੀ ਮਾੜਾ ਭਾਈ ਹੈ ਅਤੇ ਤੁਸੀਂ ਨਾ ਇਸ ਤਰ੍ਹਾਂ ਕਰਨਾ ਤੁਸੀਂ ਆਪਣਾ ਹੈ ਰੀਲਾਈਨਸ ਫਰੈਸ਼ ਵੀ ਨੇੜੇ ਹੈ ਉੱਥੋਂ ਲਿਆ ਨਾ ਕਰਨਾ ਅਤੇ ਜਾਂ ਫਿਰ ਗਲੀ ਦੇ ਬਾਹਰ ਨਿਕਲਦੇ ਹੀ ਨਾ ਗਲੀ ਨੰਬਰ ਅੱਠ ਜਿਹੜੀ ਨਾਲ ਦੇ ਪਾਸੇ ਗਲੀ ਨੰਬਰ ਅੱਠ ਦੇ ਬਾਹਰ ਸੱਜੇ ਪਾਸੇ ਲਾਉਂਦਾ ਸਬਜ਼ੀ ਵਾਲਾ ਉਹਦੀ ਸਬਜ਼ੀ ਵਧੀਆ ਹੁੰਦੀ ਪੰਜ ਦਸ ਰੁਪਏ ਮਹਿੰਗੀ ਜ਼ਰੂਰ ਹੈ ਮਗਰ ਵਧੀਆ ਹੁੰਦੀ ਹੈ ਵਧੀਆ ਸਗੋਂ ਨਾਲੇ ਆ ਬਲਿੰਕਇਟ ਵਾਲੇ ਘਰ ਵੀ ਡਿਲੀਵਰ ਕਰ ਦਿੰਦੇ ਜੇ ਬਲਿੰਕਇਟ ਵੀ ਇੱਕ ਐਪ ਹੈਗੀ ਆ ਹਾਂ ਬਾਕੀ ਕੋਈ ਨਹੀਂ ਤੁਸੀਂ ਮੇਰੇ ਵੱਲ ਆਈਓ ਮੇਰੇ ਵੱਲ ਛਕ ਲਉ ਅੱਜ ਕੋਈ ਨਹੀਂ ਕੋਈ ਨਹੀਂ ਹੋਰ ਕੋਈ ਸੇਵਾ ਹੋਏ ਤਾਂ ਦੱਸਿਓ ਤੁਸੀਂ ਨਵੇਂ ਆਏ ਹੋ ਕੋਈ ਨਹੀਂ ਆਪਾਂ ਤਿਆਰ ਹਾਂ ਮਦਦ ਕਰਨ ਨੂੰ ਹਾਜ਼ਰ ਹਾਂ ਕੋਈ ਨਹੀਂ ਕੋਈ ਨਹੀਂ ਠੀਕ ਹੈ ਭੈਣੇ